ਭਾਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਅੱਗੇ ਜਾਮ ਹੈ ਜਾਮ ਦੇ ਵਿੱਚ ਇੱਦਾਂ ਤਾਂ ਸਾਨੂੰ ਦੋ ਤਿੰਨ ਘੰਟੇ ਲੱਗ ਜਾਣਗੇ ਤੁਸੀਂ ਹੋਰ ਕੋਈ ਸ਼ਾਰਟਕੱਟ ਰਸਤਾ ਦੇਖੋ ਜਿਸ ਨਾਲ ਅਸੀਂ ਜਲਦੀ ਜਾ ਸਕੀਏ ਔਰ ਮੰਮੀ ਨੂੰ ਡਾਕਟਰ ਵੀ ਟੈਮ 'ਤੇ ਮਿਲ ਜਾਵੇ ਔਰ ਮੰਮੀ ਦਾ ਇਲਾਜ ਵੀ ਹੋ ਸਕੇ ਔਰ ਅਸੀਂ ਵੀ ਟੈਮ ਸਿਰ ਪਹੁੰਚ ਜਾਵਾਂਗੇ ਤੁਹਾਡੀ ਬੜੀ ਮਿਹਰਬਾਨੀ ਹੋਵੇਗੀ